ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਅੰਮ੍ਰਿਤ ਮੈਡਮ ਬੋਲਦੇ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਮੈਂ ਹਰਪ੍ਰੀਤ ਸਿੰਘ ਗੱਲ ਕਰ ਰਿਹਾ ਜੀ ਹਾਂਜੀ ਮੈਮ ਮੈਂ ਬੰਬੇ ਤੋਂ ਸ਼ਿਫਟ ਕੀਤਾ ਜੀ ਇੱਧਰ ਪੰਜਾਬ ਦੇ ਵਿੱਚ ਜੀ ਹਾਂਜੀ ਮੈਂ ਥੋਤੋਂ ਕੁਝ ਇਨਫੋਰਮੇਸ਼ਨ ਲੈਣੀ ਸੀ ਕਿਆ ਤੁਹਾਡੇ ਕੋਲ ਸਮਾਂ ਹੈ ਜੀ ਹਾਂਜੀ ਮੈਮ ਮੈਂ ਮੈਨੂੰ ਤੁਹਾਡਾ ਨੰਬਰ ਕਿਸੇ ਫਰੈਂਡ ਸਰਕਲ ਤੋਂ ਮਿਲਿਆ ਸੀ ਹਾਂਜੀ ਮੈਂ ਪੰਜਾਬ ਦੇ ਵਿੱਚ ਜਿੰਨੇ ਵੀ ਹਿਸਟੋਰੀਕਲ ਪਲੇਸ ਹੈ ਉੱਥੇ ਵਿਜਿਟ ਕਰਨਾ ਚਾਹੁੰਦਾ ਘੁੰਮਣਾ ਚਾਹੁੰਦਾ ਤੁਸੀਂ ਕੋਈ ਇਨਫੋਰਮੇਸ਼ਨ ਹੁਣ ਦੇ ਸਕਦੇ ਇਹਨਾਂ ਬਾਰੇ ਜੀ ਹਾਂਜੀ ਮੈਨੂੰ ਮੈਮ ਤੁਸੀਂ ਦੱਸਿਓ ਵੀ ਪੰਜਾਬ ਵਿੱਚ ਕਿਹੜੇ ਕਿਹੜੇ ਹਿਸਟੋਰੀਕਲ ਪਲੇਸ ਨੇ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਮੈਮ ਮੈਂ ਇਸ ਤੋਂ ਇਲਾਵਾ ਹੋਰ ਕਿਹੜੀ ਸਿਟੀ ਦੇ ਵਿੱਚ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਮੈਮ ਠੀਕ ਠੀਕ ਹੈ ਮੈਮ ਕੋਈ ਨਾ ਮੇਰਾ ਨਾ ਆਪਣੇ ਦੋ ਹਜ਼ਾਰ ਚੌਵੀ ਜਨਵਰੀ ਦੇ ਵਿੱਚ ਦਾ ਪਲੈਨ ਬਣ ਰਿਹਾ ਜੀ ਘੁੰਮਣ ਦਾ ਅਤੇ ਜਦੋਂ ਉਦੋਂ ਆਪਾਂ ਤੁਹਾਨੂੰ ਕਾਲ ਕਰ ਸਕਾਂ ਤੁਹਾਡੇ ਕੋਲ ਟਾਈਮ ਹੋਇਆ ਤਾਂ ਅਸੀਂ ਤੁਹਾਡੀ ਹੈਲਪ ਲੈ ਸਕਦੇ ਹਾਂ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਓਕੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ